ਵੈਸੇ ਤਾਂ ਸਰਕਾਰ ਨੇ ਕਾਫੀ ਸਾਰੀ ਸਰਕਾਰੀ ਯੋਜਨਾਵਾਂ ਕੱਢੀਆਂ ਨੇ ਜਾਂ ਸਰਕਾਰੀ ਸਕੀਮਾਂ ਕੱਢੀਆਂ ਨੇ ਜਿਨ੍ਹਾਂ ਦਾ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਵਾ ਭਾਵੇਂ ਉਹ ਬੱਚੇ ਹੋਣ ਭਾਵੇਂ ਵੱਡੇ ਹੋਣ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੋਇਆ ਅੱਜ ਕੱਲ ਕੋਈ ਵੀ ਬੱਚਾ ਘੱਟ ਪੇ ਪੈਸੇ ਦੇ ਵਿੱਚ ਪੜ੍ਹ ਸਕਦਾ ਹੈ ਖਾਸਕਰ ਐਸ ਸੀ ਕੋਟੇ ਦੇ ਵਿੱਚ ਜਿੰਨੇ ਵੀ ਬੱਚੇ ਨੇ ਉਹ ਅੱਜ ਕੱਲ ਫਰੀ ਵੀ ਪੜ੍ਹ ਰਹੇ ਨੇ ਜਾਂ ਕਾਫੀ ਸਾਰੇ ਲੋਅ ਇਨਕਮ ਦੀ ਸਕੀਮ ਨਾਲ ਵੀ ਪੜ੍ਹ ਸਕਦੇ ਨੇ ਅੱਜ ਕੱਲ ਸਕੂਲ ਕਾਲਜਾਂ ਦੇ ਵਿੱਚ ਬੱਚਿਆਂ ਦੇ ਲਈ ਜਾਣਾ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈਗੀ ਅੱਜ ਕੱਲ ਹਰ ਕੋਈ ਪੜ੍ਹ ਸਕਦਾ ਹੈ ਹਰ ਕੋਈ ਲਿਖ ਸਕਦਾ ਹੈ ਅੱਜ ਕੱਲ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਵੀ ਖੋਲ੍ਹ ਦਿੱਤੀਆਂ ਗਈਆਂ ਨੇ ਸਾਫ ਸੁਥਰੀਆਂ ਡਿਸਪੈਂਸਰੀਆਂ ਜਿਨ੍ਹਾਂ ਦਾ ਕਾਫੀ ਸਾਰਾ ਲਾਭ ਹੋਇਆ ਇਸ ਦੇ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਨੇ ਸਾਨੂੰ ਬਹੁਤ ਸਾਰੀ ਲਾਭਦਾਇਕ ਵਿਵਸਥਾਵਾਂ ਦਿੱਤੀਆਂ ਨੇ ਜਾਂ ਲਾਭਦਾਇਕ ਸਕੀਮਾਂ ਦਿੱਤੀਆਂ ਨੇ ਇਹਨਾਂ ਦੇ ਬਹੁਤ ਸਾਰੇ ਫਾਇਦੇ ਵੀ ਹੋਏ ਨੇ ਜਿੱਦਾਂ ਕਿ ਬੇਟੀ ਪੜਾਓ ਬੇਟੀ ਬਚਾਓ ਅੱਜ ਕੱਲ ਹਰ ਕੋਈ ਬੇਟੀ ਹਰ ਘਰ ਘਰ ਦੀ ਬੇਟੀ ਹਰ ਕੋਈ ਪੜ੍ਹ ਸਕਦਾ ਹੈ ਕਿਸੇ ਨੂੰ ਇੱਦਾਂ ਨਹੀਂ ਹੈਗਾ ਕਿ ਕਿਸੇ ਨੂੰ ਪੜ੍ਹਾਈ ਤੋਂ ਰੋਕਿਆ ਜਾ ਸਕਦਾ ਹੈ ਹਰ ਕਿਸੇ ਨੂੰ ਪੜ੍ਹਾਈ ਜਾ ਸਕਦੀ ਹੈ ਅੱਜ ਕੱਲ ਜਿੰਨੀਆਂ ਵੀ ਐਜੂਕੇਸ਼ਨ ਦੀ ਗੱਲ ਕਰ ਦਿੱਤੀ ਜਾਵੇ ਜਾਂ ਮੈਡੀਕਲ ਸਕੀਮ ਦੀ ਗੱਲ ਕੀਤੀ ਜਾਵੇ ਹਰ ਪਾਸੇ ਤੁਹਾਨੂੰ ਯੋਜਨਾਵਾਂ ਤਾਂ ਮਿਲਣਗੀਆਂ ਮਿਲਣਗੀਆਂ ਜਾਂ ਚੰਗੀਆਂ ਸਕੀਮਾਂ ਤਾਂ ਮਿਲਣਗੀਆਂ ਮਿਲਣਗੀਆਂ ਅੱਜ ਕੱਲ ਦਵਾਈਆਂ ਵੀ ਇਸ ਕਰਕੇ ਕਾਫੀ ਘੱਟ ਰੇਟ 'ਤੇ ਵੀ ਤੁਹਾਨੂੰ ਮਿਲ ਜਾਂਦੀਆਂ ਨੇ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਕਾਫੀ ਸਾਰੇ ਸਾਨੂੰ ਲਾਭਦਾਇਕ ਸਕੀਮਾਂ ਮਿਲੀਆਂ ਨੇ ਜਿਨ੍ਹਾਂ ਕਰਕੇ ਅਸੀਂ ਹ ਇਸ ਹੱਦ ਤੱਕ ਇਹ ਗੱਲ ਕਹਿ ਸਕਦੇ ਹਾਂ ਕਿ ਅੱਜ ਕੱਲ ਕਾਫੀ ਜ਼ਿਆਦਾ ਬੰਦਿਆਂ ਦੀ ਜ਼ਿੰਦਗੀ ਲਗਭਗ ਸੌਖੀ ਹੋ ਚੁੱਕੀ ਹੈ ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਸਰਕਾਰੀ ਸਕੀਮਾਂ ਸਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੋਈਆਂ ਜਿਨ੍ਹਾਂ ਕਰਕੇ ਕਾਫੀ ਤੋਂ ਕਾਫੀ ਸਾਰੇ ਬੱਚੇ ਆਪਣੇ ਪੜ੍ਹਾਈ ਵੀ ਕਰ ਸਕੇ ਅਤੇ ਕਾਫੀ ਸਾਰੇ ਪਿੰਡਾਂ ਦੇ ਵਿੱਚ ਜੋ ਆਪਣੇ ਇਲਾਜ ਨਹੀਂ ਕਰਵਾ ਸਕਦੇ ਸੀ ਉਹ ਆਪਣਾ ਇਲਾਜ ਵੀ ਚੰਗੀ ਜਗ੍ਹਾ ਕਰਵਾ ਸਕਦੇ ਨੇ ਸਰਕਾਰੀ ਕੋਲਜ ਵੀ ਗੱਲ ਕੀਤੀ ਜਾਵੇ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਜਾ ਸਾਕਰ ਸਰਕਾਰੀ ਦਫਤਰਾਂ ਦੀ ਗੱਲ ਕੀਤੀ ਜਾਵੇ ਹਰ ਬੰਨੇ ਸਰਕਾਰ ਨੇ ਆਪਣੀ ਸਕੀਮਾਂ ਕੱਢੀਆਂ ਹੀ ਹੈ ਅਤੇ ਜਿਨ੍ਹਾਂ ਦਾ ਸਾਰੇ ਲੋਕਾਂ ਨੂੰ ਫਾਇਦਾ ਹੋਇਆ ਹੈ ਥੈਂਕ ਯੂ